ਚਿੱਤਰਕਾਰੀ ਮੈਨੂੰ ਸਕੂਲ ਟਾਈਮ ਤੋਂ ਹੀ ਪਸੰਦ ਹੈਗੀ ਆ ਅਤੇ ਸਕੂਲ 'ਚ ਮੈਂ ਸਾਰਿਆਂ ਨਾਲੋਂ ਪਹਿਲਾਂ ਗਰਾਸ ਬਣਾਉਂਦਾ ਗਰਾਸ ਜਿਹੜਾ ਘਾਹ ਹੁੰਦਾ ਆਪਾਂ ਹਰਾ ਹਰਾ ਮੈਂ ਕਲਰ ਕਰਦਾ ਉਹ 'ਤੇ ਕ ਝੌਂਪੜੀ ਬਣਾਉਂਦਾ ਝੌਂਪੜੀ ਮੈਨੂੰ ਅੱਜ ਵੀ ਮੈਂ ਬਣਵਾ ਕੇ ਦ ਦੇ ਦਿੰਦਾ ਬੱਚੇ ਨੂੰ ਬਣਾ ਦਿੰਦਾ ਗਾ ਬਹੁਤ ਖੁਸ਼ ਹੁੰਦਾ ਬਹੁਤ ਵਧੀਆ ਝੌਂਪੜੀ ਬਣਾਉਣੇ ਆ ਮੈਂ ਅਤੇ ਕਾਫੀ ਵਧੀਆ ਉਹ 'ਚ ਅਲੱਗ ਅਲੱਗ ਰੈਕ ਬਣਾਉਂਦੇ ਅਲੱਗ ਅਲੱਗ ਕਲਰ ਕਰ ਦਿੰਦੇ ਆ ਅਤੇ ਉੱਦੂ ਬਾਅਦ ਐਂਈਂ ਸਫਰ ਚਲਦਾ ਰਿਹਾ ਅਤੇ ਪਲੱਸ ਵਨ ਪਲੱਸ ਟੂ ਫਿਰ ਮੈਂ ਡਰਾਇੰਗ ਰੱਖ ਲਈ ਅਤੇ ਉਹ 'ਚ ਵੋਕੇਸ਼ਨਲ ਡਰਾਇੰਗ ਸੀਗੀ ਉਹ 'ਚ ਮੈਂ ਬਹੁਤ ਹੱਥ ਇੰਨਾ ਟਿੱਕ ਗਿਆ ਕਿ ਹੁਣ ਜੇ ਕਿਸੇ ਨੇ ਇਸ ਤਰ੍ਹਾਂ ਕੋਈ ਲਾਈਨ ਖਿੱਚੀ ਹੈ ਨਾ ਤਾਂ ਉਹਦੇ 'ਚ ਕਿ ਮਾੜੀ ਮੋਟੀ ਟੇਢੀ ਹੈ ਤਾਂ ਮੈਂ ਮਿਣ ਕੇ ਨਹੀਂ ਵੈਸੇ ਇੰਨਾ ਐਕਸਪੀਰੀਅੰਸ ਹੋ ਗਿਆ ਹੁਣ ਪਰਮਾਤਮਾ ਕਿ ਮੈਂ ਦੇਖ ਕੇ ਦੱਸ ਸਕਦਾ ਹੈਗਾ ਕਿ ਹਾਂ ਵੀ ਇਹ 'ਚ ਆਹ ਲਾਈਨ ਟੇਢੀ ਹੈਗੀ ਬਹੁਤ ਬੁੱਧੀ ਯੋਗੀ ਇੱਕ ਮਾਸਟਰ ਸਰਕਾਰੀ ਸੀਗੇ ਉਹਨਾਂ ਨੇ ਪੂਰਾ ਭਰ ਭਰ ਕੇ ਤੁੰਨਿਆ ਸਾਨੂੰ ਇੱਕ ਮੇਰੇ ਨਾਲ ਮੁੰਡਾ ਸੀਗਾ ਮੇਰੇ ਪਿੰਡੋਂ ਹੀ ਅਤੇ ਅਸੀਂ ਬਹੁਤ ਵਧੀਆ ਡਰਾਇੰਗ ਸਿੱਖੀ ਅਤੇ ਉਹੀ ਮੈਂ ਹੁਣ ਆਪਦੇ ਬੱਚੇ 'ਤੇ ਐਪਲੀਕੇਬਲ ਕਰਦਾ ਹੈਗਾ ਉਹਨੂੰ ਵੀ ਕਾਫੀ ਸ਼ੌਕ ਆ ਮੇਰੇ ਬੱਚੇ ਨੂੰ ਵੀ ਮੈਂ ਉਹਨੂੰ ਸਿਖਾਉਂਦਾ ਵੀ ਐਂ ਕਰੀਦਾ ਹੁੰਦਾ ਹੁਣ ਜਿਵੇਂ ਕਲਰਿੰਗ ਹੈ ਕਲਰਿੰਗ ਦੇ ਅਲੱਗ ਅਲੱਗ ਸ਼ੇਡ ਹੁੰਦੇ ਨੇ ਮੰਨ ਲਓ ਆਪਾਂ ਇੱਕ ਸਾਈਡ ਨੂੰ ਕਲਰਿੰਗ ਕਰਨੀ ਹੁੰਦੀ ਹੈ ਐਂ ਨਹੀਂ ਵੀ ਅਲੱਗ ਅਲੱਗ ਸਾਈਡਾਂ ਤੋਂ ਕਰੀ ਜਾਉ ਗਾਚਾ ਮਾਚਾ ਜਿਹਾ ਕਰੀ ਜਾਓ ਉਹ ਸਹੀ ਨਹੀਂ ਹੁੰਦਾ ਇੱਕ ਸਾਈਡ ਨੂੰ ਕਲਰ ਕਰਦੇ ਆ ਫਿਰ ਉਹ ਵਧੀਆ ਲੱਗਦੇ ਫੇਰ ਹੀ ਕਲਰ ਸਹੀ ਹੁੰਦਾ ਹੈਗਾ